ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਓਕੇ ਹਾਂਜੀ ਕਰੋ ਹਾਂਜੀ ਜਿਹੜੀ ਰਾਵੀ ਰਿਵਰ ਹੈ ਹੈ ਨਾ ਇਹ ਆਪਣੇ ਕਾਂਗੜਾ ਅਤੇ ਹਿਮਾਚਲ ਪ੍ਰਦੇਸ਼ ਵੱਲ ਪੈ ਜਾਂਦੀ ਹੈ ਜਿਹੜਾ ਪਠਾਨਕੋਟ ਡਿਸਟਿਕਟ ਪੰਜਾਬ ਦੇ ਵੱਲ ਫਲੋ ਕਰਦੀ ਹੈ ਨਾ ਫਿਰ ਉਸ ਤੋਂ ਬਾਅਦ ਆਪਣੇ ਆਉਂਦੀ ਸਤਲੁਜ ਰਿਵਰ ਜਿਹੜੀ ਮਤਲਬ ਲੋਂਗੈਸਟ ਰਿਵਰ ਏ ਆਪਣੀ ਪੰਜਾਬ ਦੀ ਹੈ ਨਾ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਏ ਬਿਆਸ ਉਹ ਜਿਹੜੀ ਈਸਟਨ ਆ ਜਾਂਦੀ ਹੁਣ ਜਿਵੇਂ ਆਪਣੇ ਠੀਕ ਹੈ ਬਿਆਸ ਸਤਲੁਜ ਦੀ ਜਿਹੜੀ ਰਿਵਰ ਉਹਨੂੰ ਘੱਗਰ ਕਹਿ ਦਿੰਦੇ ਹਾਂ ਜਿਹੜਾ ਵਰਡ ਹੈ ਹਾਂਜੀ ਜਿਹੜੀ ਆਪਣੀ ਸਭ ਤੋਂ ਵੱਧ ਜਿਹੜੀ ਵਗਦੀ ਹੈ ਨਾ ਪੰਜਾਬ 'ਚ ਉਹ ਹੈਗੀ ਸਤਲੁਜ ਰਿਵਰ ਹੈ ਨਾ ਇਹ ਨਾਦਰਨ ਇੰਡੀਆ ਵੱਲ ਪੈ ਜਾਂਦੀ ਆ ਹਾਂਜੀ ਜਿਹੜੀ ਇਹ ਨਦੀਆਂ ਇਹਨਾਂ ਨਦੀਆਂ ਦਾ ਓਰਿਜਨ ਪੰਜਾਬ ਤੋਂ ਹੀ ਹੈ ਅਤੇ ਪੰਜ ਮਿਨਸ ਪੰਜ ਦਰਿਆ ਦੀ ਧਰਤੀ ਆ ਹਾਂ ਜਿਹੜੀ ਇਸਦੀ ਜਿਹੜੀ ਇਹ ਪੰਜਾਬ ਦੇ ਸਬਕੋਟੀਨਿਊ ਸੈਂਚੁਰੀ 'ਚ ਸ਼ੁਰੂ ਹੋਈ ਸੀ ਹੈ ਨਾ ਇਹਨਾਂ ਦੀ ਅਤੇ ਸ਼ੇਰ ਸ਼ਾਹ ਸੂਰੀ ਸੀ ਪੰਦ ਪੰਦਰ੍ਹਾਂ ਸੌ ਚਾਲ੍ਹੀ ਅਤੇ ਪੰਦਰ੍ਹਾਂ ਸੌ ਪੰਤਾਲੀ ਵਿੱਚ ਇਹਨਾਂ ਦੇ ਫਾਊਂਡਰ ਸੀ ਨੋਰਥ ਇੰਡੀਅਨ ਦੇ ਜਿਹੜੇ ਹਾਂਜੀ ਜਿਹੜੀ ਇਹ ਰਿਵਰ ਏ ਹੈ ਨਾ ਉਹਨਾਂ ਦਾ ਮਤਲਬ ਉਰੀਜਨ ਜਿਹੜਾ ਹੋਇਆ ਹੋਇਆ